ਗਿਆਰਾਂ ਦੋ ਸੌ ਬਵੰਜਾ ਚਾਰ ਹਜ਼ਾਰ ਪੰਜ ਸੌ ਇਕਾਹਠ ਛੇਹੱਤਰ ਹਜ਼ਾਰ ਪੰਜ ਸੌ ਇਕਾਹਠ ਅੱਠ ਲੱਖ ਚੁਰੰਜਾ ਹਜ਼ਾਰ ਸੱਤ ਸੌ ਅੱਸੀ